ਮੇਰੇ ਬਚਪਨ ਵਿੱਚ ਮੈਂ ਗੁੱਡੀਆਂ ਪਟੋਲੇ ਬਹੁਤ ਖੇਡੇ ਨੇ ਗੁੱਡੀਆਂ ਖੇਡਣ ਲਈ ਅਸੀਂ ਸਵੇਰੇ ਹੀ ਗੁੱਡੀਆਂ ਬਣਾ ਲੈਣੀਆਂ ਲੀਰਾਂ ਵੀ ਇਕੱਠੀਆਂ ਕਰਨੀਆਂ ਗੁੱਡੀਆਂ ਬਣਾਉਣੀਆਂ ਸੂਈ ਧਾਗਿਆਂ ਨਾਲ ਉਹਨਾਂ ਦੇ ਨੈਣ ਨਕਸ਼ ਬਣਾਉਣੇ ਹਾਂ ਗੁੱਡੀ ਸਾਰਾ ਸਾਰਾ ਦਿਨ ਖੇਡਣੀਆਂ ਥੱਕਣਾ ਨਾ ਉਹਨਾਂ ਦੇ ਕੱਪੜੇ ਬਣਾਉਣੇ ਛੋਟੀਆਂ ਛੋਟੇ ਦੀਵੇ ਕੁੱਜੀਆਂ ਇਕੱਠੀਆਂ ਕਰਨੀਆਂ ਅਤੇ ਉਹਨਾਂ ਦੇ ਵਿੱਚ ਸਾਰਾ ਸਾਰਾ ਦਿਨ ਚੌਲ ਭਿਓਂਈ ਜਾਣੇ ਅਤੇ ਉਹੀ ਖਾਈ ਜਾਣੇ ਪਤਾ ਨਹੀਂ ਉਹਨਾਂ 'ਚ ਕੀ ਸਵਾਦ ਆਉਂਦਾ ਸੀ ਉਹਨਾਂ ਖੇਡਾਂ ਦੇ ਵਿੱਚ ਕੋਈ ਨਿਯਮ ਨਹੀਂ ਸਨ ਹੁੰਦੇ ਬਸ ਘਰ ਕੋਠਾ ਬਣਾਉਣਾ ਢਾਹ ਦੇਣਾ ਕਿਸੇ ਦੇ ਘਰ ਚਲੇ ਜਾਣਾ ਬੜਾ ਮਜ਼ਾ ਆਉਂਦਾ ਸੀ ਉਹਨਾਂ ਦੇ ਵਿੱਚ ਉਸ ਤੋਂ ਬਿਨਾਂ ਬਾਂਦਰ ਕਿਲਾ ਖੇਡਣਾ ਜੋ ਕਿ ਬੜਾ ਹੀ ਮਜ਼ੇਦਾਰ ਸੀ ਲੀਰਾਂ ਦੀ ਖਿਦੋਂ ਬਣਾਉਣੀ ਸਾਰਿਆਂ ਦੀਆਂ ਚੱਪਲਾਂ ਇਕੱਠੀਆਂ ਕਰਨੀਆਂ ਇੱਕ ਕਿੱਲੇ ਨਾਲ ਬੰਨਣੀਆਂ ਅਤੇ ਚ ਉਹੀ ਚੱਪਲਾਂ ਇੱਕ ਦੂਜੇ ਨੂੰ ਮਾਰਨੀਆਂ ਉਹਦੇ ਵਿੱਚ ਤਾਂ ਅਲੱਗ ਹੀ ਮਜ਼ਾ ਆਉਂਦਾ ਸੀ